ਆਪਣੇ ਸਰੀਰ ਨੂੰ ਰਿਸ਼ਟ ਪੁਸ਼ਟ ਅਤੇ ਤੰਦਰੁਸਤ ਰੱਖਣ ਲਈ ਦੌੜਨਾ ਪ੍ਰੈਕਟਿਸ ਕਰਨਾ ਪੈਦਲ ਚੱਲਣਾ ਮੋਰਨਿੰਗ ਵਾਕ ਕਰਨਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਮੇਰੀ ਦੋ ਟਾਈਮ ਦੀ ਰੂਟੀਨ ਹੈ ਮੈਂ ਰੋਜ਼ਾਨਾ ਮੋਰਨਿੰਗ ਅਤੇ ਇਵਨਿੰਗ ਟਾਈਮ ਦੌੜਦਾ ਹਾਂ ਸੈਰ ਕਰਦਾ ਹਾਂ ਸੈਰ ਕਰਨ ਦੇ ਨਾਲ ਨਾਲ ਮੇਰੀ ਜਿਹੜੀ ਡੇਲੀ ਦੀ ਰੂਟੀਨ ਆ ਡੇਲੀ ਦੇ ਕੰਮਕਾਰ ਨੇ ਮੋਰਨਿੰਗ ਟਾਈਮ ਮੈਂ ਦੇਖਣਾ ਵੀ ਮੈਂ ਦਿਹਾੜੀ ਦੇ ਵਿੱਚ ਕੀ ਕਰਨਾ ਅਤੇ ਜਦੋਂ ਸ਼ਾਮ ਨੂੰ ਮੈਂ ਸੈਰ 'ਤੇ ਨਿਕਲਣਾ ਉਸ ਟਾਈਮ ਮੈਂ ਚੈੱਕ ਕਰਨਾ ਵੀ ਦਿਹਾੜੀ 'ਚ ਅੱਜ ਮੈਂ ਕੀ ਕੀਤਾ ਅਤੇ ਕੀ ਨਹੀਂ ਕੀਤਾ ਕਿਸ ਦਾ ਮੈਂ ਚੰਗਾ ਅਤੇ ਕਿਸ ਦਾ ਮਾੜਾ ਜੋ ਵੀ ਮੇਰੀ ਜ਼ਿੰਦਗੀ ਦੀ ਇੱਕ ਦਿਹਾੜੀ ਦੀ ਲਾਈਫ ਦੇ ਵਿੱਚ ਚੱਲ ਰਿਹਾ ਹੁੰਦਾ ਮੈਂ ਉਸ ਬਾਰੇ ਹਰੇਕ ਮੂਮੈਂਟ ਆਪਣੇ ਦਿਮਾਗ ਦੇ ਵਿੱਚ ਲਿਆਉਂਦਾ ਹਾਂ ਉਸ ਤੋਂ ਬਾਅਦ ਫਰੀ ਹੋਣ ਤੋਂ ਬਾਅਦ ਸਵੇਰ ਅਤੇ ਸ਼ਾਮ ਟਾਈਮ ਮੇਰੀ ਜਿਹੜੀ ਮੇਨ ਮੇਰਾ ਮੁੱਖ ਕੰਮ ਹੈ ਮੈਂ ਦਰਬਾਰ ਸਾਹਿਬ ਤੋਂ ਟੈਲੀਕਾਸਟ ਚੱਲਦਾ ਹੁੰਦਾ ਲਾਈਵ ਟੈਲੀਕਾਸਟ ਮੈਂ ਆਪਣੇ ਕੰਨਾਂ ਦੇ ਵਿੱਚ ਹੈਡਫੋਨ ਲਾ ਕੇ ਉਸ ਨੂੰ ਸੁਣਨਾ ਮੇਰੇ ਮਨ ਨੂੰ ਸ਼ਾਂਤੀ ਅਤੇ ਮੇਰੇ ਮਨ ਨੂੰ ਸਕੂਨ ਮਿਲਦਾ ਹੈ ਜੋ ਕਿ ਮੈਂ ਰ ਰੋਜ਼ਾਨਾ ਹੀ ਕਰਦਾ ਹਾਂ ਆਪਣੇ ਸਰੀਰ ਨੂੰ ਤੁਹਾਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਤੁਹਾਡੀ ਜਿਹੜੀ ਮੋਰਨਿੰਗ ਵਾਕ ਅਤੇ ਇਵਨਿੰਗ ਵਾਕ ਬਹੁਤ ਹੀ ਜ਼ਰੂਰੀ ਹੈ ਜੇ ਤੁਹਾਡਾ ਸਰੀਰ ਗਿਆ ਤਾਂ ਤੁਹਾਡਾ ਸਾਰਾ ਕੁਛ ਹੀ ਗਿਆ ਮੇਰਾ ਮੰਨਣਾ ਇਹ ਹੈ ਹਰੇਕ ਬੰਦੇ ਨੂੰ ਛੋਟੇ ਤੋਂ ਲੈ ਕੇ ਵੱਡੇ ਤੱਕ ਜਿੰਨੀ ਬੰਦੇ ਦੀ ਕਪੈਸਿਟੀ ਆ ਉਸਦੇ ਹਿਸਾਬ ਨਾਲ ਉਸਨੂੰ ਦੌੜਨਾ ਅਤੇ ਜਾਣਾ ਚਾਹੀਦਾ ਹੈ